ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਈ ਆਈ ਟੀ ਮਦਰਾਸ ਤੋਂ ਬੋਲ ਰਹੀ ਹਾਂ ਜੀ ਤੁਸੀਂ ਮਿਊਜਿਕ ਟੀਚਰ ਹੋ ਮੈਂ ਨਾ ਐਕਚੁਲੀ ਆਪਣੇ ਬੇਟੇ ਦੀ ਐਡਮਿਸ਼ਨ ਕਰਵਾਉਣੀ ਸੀ ਅਤੇ ਤੁਹਾਡੀ ਜਿਹੜੀ ਐਡਮਿਸ਼ਨ ਦੇ ਮਤਲਬ ਕਿ ਤੁਸੀਂ ਕੀ ਫੀਸ ਲੈਂਦੇ ਹੋ ਅਤੇ ਮਹੀਨੇ 'ਚ ਕਿਹੜੇ ਦਿਨ ਅਸੀਂ ਆਈਏ ਤੁਹਾਡੇ ਕੋਲ ਹਾਂ ਹਾਂ ਮੇਰੇ ਜੀ ਦੇਖੋ ਮੇਰਾ ਜਿਹੜਾ ਬੇਟਾ ਉਹਨੂੰ ਇੱਕ ਤਾਂ ਤਬਲੇ ਵਿੱਚ ਬਹੁਤ ਇੰਟਰਸਟ ਹੈ ਅਤੇ ਦੂਜਾ ਉਹਨੂੰ ਹਾਰਮੋਨਿਅਮ ਦੀਆਂ ਸੁਰਾਂ ਬਾਰੇ ਵੀ ਕਾਫੀ ਗਿਆਨ ਹੈ ਉਹ ਗਾ ਵੀ ਬਹੁਤ ਸੋਹਣਾ ਲੈਂਦਾ ਅਤੇ ਉਹਦੀ ਦਿਲੀ ਇੱਛਾ ਅਤੇ ਮੇਰੀ ਦਿਲੀ ਇੱਛਾ ਇਹ ਹੀ ਹੈ ਕਿ ਮੈਂ ਦੋਨੋਂ ਚੀਜ਼ਾਂ ਹੀ ਉਹਨੂੰ ਕਰਾਵਾਂ ਹਾਰਮੋਨੀਅਮ ਅਤੇ ਉੱਚ ਰਾਗਾਂ ਦੀ ਪੂਰੀ ਉਹਨੂੰ ਨੌਲੇਜ ਆ ਜਾਵੇ ਇੱਕ ਉਹਨੂੰ ਤਬਲਾ ਵਜਾਉਣਾ ਆ ਜਾਵੇ ਉਹ 'ਚ ਸਾਰੀਆਂ ਤਾਲਾਂ ਆ ਜਾਣ ਕੀ ਇਹ ਦੋਨੋਂ ਜਿਹੜੇ ਐਟ ਏ ਟਾਈਮ ਇੱਕੋ ਹੀ ਸਮੇਂ ਸ਼ੁਰੂ ਹੋ ਸਕਦੇ ਹੈ ਜਾਂ ਤਬਲੇ ਦੀ ਕਲਾਸ ਵੱਖਰੀ ਹੋਵੇਗੀ ਹਾਰਮੋਨੀਅਮ ਦੀ ਕਲਾਸ ਦੀ ਵੱਖਰੇ ਦਾ ਟਾਈਮ ਹੋਵੇਗਾ ਕਿਵੇਂ ਮੈਨੂੰ ਦੱਸੋ ਸਾਰਾ ਕੀ ਸ਼ੈਡਿਊਲ ਕਰੋਗੇ ਤੁਸੀਂ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਮੈਨੂੰ ਇਹ ਦੱਸੋਂਗੇ ਜੀ ਫਿਰ ਅਸੀਂ ਜਿਹੜੀ ਫੀਸ ਹੈ ਉਹ ਇੱਕ ਮਹੀਨਾ ਜਦੋਂ ਖ਼ਤਮ ਹੁੰਦਾ ਉਸ ਤੋਂ ਬਾਅਦ ਦੇਵਾਂਗੇ ਜਾਂ ਤੁਸੀਂ ਅਡਵਾਂਸ ਫੀਸ ਲੈਂਦੇ ਹੋ ਪਹਿਲਾਂ ਕੋਈ ਅਡਮਿਸ਼ਨ ਅਤੇ ਰਜਿਸਟਰੇਸ਼ਨ 'ਤੇ ਜਿਹੜੇ ਤੁਹਾਡੇ ਚਾਰਜ ਨੇ ਵੱਖਰੇ ਹੋਣਗੇ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਮੈਂ ਨਾ ਫਿਰ ਮੈਂ ਤੁਹਾਡਾ ਜਿਹੜਾ ਨੰਬਰ ਹੈ ਨੋਟ ਕਰ ਲਿਆ ਜੀ ਅਤੇ ਅਸੀਂ ਸੋਮਵਾਰ ਨੂੰ ਆ ਕੇ ਨਾ ਮੈਂ ਬੇਟੇ ਨੂੰ ਵੀ ਨਾਲ ਲਿਆਵਾਂਗੀ ਅਤੇ ਉਹਦੀ ਰਜਿਸਟਰੇਸ਼ਨ ਕਰਵਾ ਜੂੰਗੀ ਅਤੇ ਨਾਲੇ ਕਲਾਸਿਸ ਅਟੈਂਡ ਕਰ ਲੇਗਾ ਬੇਟਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ